ਸਾਡੇ ਇਲਾਕੇ 'ਚ ਬਹੁਤ ਡੋਕਟਰ ਹਨ ਬਹੁਤ ਵਧੀਆ ਹੋਸਪਿਟਲ ਨੇ ਕੋਈ ਹੱਡੀਆਂ ਦਾ ਹੈ ਕੋਈ ਫਿਜਓਥੈਰਪਿਸਟ ਹੈ ਕੋਈ ਗਾਈਨੀ ਹੈ ਸਕਿੰਨ ਦੇ ਵੀ ਦੋ ਤਿੰਨ ਵੱਡੇ ਵੱਡੇ ਹੋਸਪਿਟਲ ਖੁੱਲ੍ਹੇ ਹਨ ਡਿਲੀਵਰੀਆਂ ਦਾ ਬੱਚਿਆਂ ਦੀ ਡਿਲੀ ਡਿਲੀਵਰੀਆਂ ਦਾ ਸਪੈਸ਼ਲ ਹੋਸਪਿਟਲ ਹੈ ਦੋ ਅਤੇ ਇੱਕ ਮਲਟੀ ਹੋਸਪਿਟਲ ਵੀ ਹੈ ਅਤੇ ਅੱਡ ਅੱਡ ਕਲੀਨਿਕਸ ਵੀ ਖੁੱਲ੍ਹੇ ਹੋਏ ਹੈਗੇ ਹਨ ਅਤੇ ਜਿਹਨ ਜਿੰਨੇ ਵੀ ਸਾਡੇ ਸ਼ਹਿਰ ਦੇ ਜਾ ਸਾਡੇ ਇਲਾਕੇ ਦੇ ਲੋਕ ਹਨ ਉਹਨਾਂ ਨੂੰ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ ਸਿਹਤ ਨੂੰ ਲੈ ਕੇ ਅਤੇ ਉੱਪਰੋਂ ਡਾ ਡੋਕਟਰ ਨਰਸਜ਼ ਸਰਜਨਜ਼ ਇਹ ਟਾਈਮ ਟੂ ਸਮੇਂ ਤੋਂ ਸਮੇਂ ਐਵੇਲੇਬਲ ਹਨ ਅਤੇ ਦੇਖਦੇ ਹੈ ਚੰਗੀ ਤਰ੍ਹਾਂ ਜਿਹੜੇ ਮੈਡੀ ਸਾਡੇ ਇਲਾਕੇ ਵਿੱਚ ਇੱਥੇ ਇੱਕ ਯੂਨੀਵਰਸਿਟੀ ਅਤੇ ਕੋਲਜ ਹਨ ਜਿਹਦੇ ਵਿੱਚ ਮੈਡੀਕਲ ਸਟੂਡੈਂਟਾਂ ਨੂੰ ਪੜ੍ਹਾਇਆ ਜਾਂਦਾ ਅਤੇ ਅੱਡ ਅੱਡ ਕੋਰਸਿਜ਼ ਕਰਾਏ ਜਾਂਦੇ ਆ ਅਤੇ ਉੱਥੇ ਬਕਾਇਦਾ ਉਹਨਾਂ ਦਾ ਪ੍ਰੋਪਰ ਕੋਰਸ ਹੁੰਦਾ ਪ੍ਰੋਪਰ ਉਹਨਾਂ ਨੂੰ ਸਹੀ ਤਰੀਕੇ ਨਾਲ ਸਿਖਾਇਆ ਜਾਂਦਾ ਸਾਰਾ ਕੁਛ ਵੀ ਮਰੀਜ਼ਾਂ ਨੂੰ ਕਿਵੇਂ ਹੈਂਡਲ ਕਰਨਾ ਕਿਵੇਂ ਦੇਖਣਾ ਸੰਭਾਲਣਾ ਅਤੇ ਉਹਨਾਂ ਦੀ ਮੁਸ਼ਕਿਲ ਨੂੰ ਹੱਲ ਕਰਨਾ ਸਿਹਤ ਦੇ ਰਿਲੇਟਡ ਅਤੇ ਇੱਥੇ ਸਾਡੇ ਇਲਾਕੇ 'ਚ ਮੁਫ਼ਤ ਕੈਂਪ ਮੁਫ਼ਤ ਓ ਪੀ ਡੀ ਇਹ ਸਭ ਕੁਛ ਵੀ ਚੱਲਦਾ ਜਿਹਦੇ ਨਾਲ ਕਿ ਬੱਚਿਆਂ ਨੂੰ ਐਕਸਪੋਜ਼ਰ ਮਿਲਦਾ ਬੱਚੇ ਸਿੱਖਦੇ ਆ ਅੱਡ ਅੱਡ ਨਵਾਂ ਐਕਸਪੀਰੀਅੰਸ ਉਹਨਾਂ ਨੂੰ ਮਿਲਦਾ ਅਤੇ ਦੂਜੀ ਗੱਲ ਜਿਹੜੇ ਲੋੜਵੰਦ ਹੁੰਦੇ ਆ ਉਹਨਾਂ ਦੀ ਮਦਦ ਵੀ ਹੋ ਜਾਂਦੀ ਹੈ ਉਹ ਠੀਕ ਵੀ ਹੋ ਜਾਂਦੇ ਨੇ